ਬਰਸਾਤ ਦੇ ਮੌਸਮ ਦੇ ਵਿੱਚ ਡੇਂਗੂ ਵਰਗੀਆਂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਆਮ ਹੀ ਹੋ ਜਾਂਦੀਆਂ ਹਨ ਇਸ ਦੇ ਬਚਾਅ ਲਈ ਬਹੁਤ ਹੀ ਤਰ੍ਹਾਂ ਦੇ ਉਪਾਅ ਆਪਾਂ ਘਰੇਲੂ ਤੌਰ 'ਤੇ ਕਰ ਸਕਦੇ ਹਾਂ ਜਿਵੇਂ ਕਿ ਘਰ ਦੀਆਂ ਛੱਤਾਂ ਦੇ ਉੱਤੇ ਪਾਣੀ ਨਹੀਂ ਖੜ੍ਹਨ ਦੇਣਾ ਟਾਇਰ ਵਗੈਰਾ ਜਾਂ ਘੜੇ ਉਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਬਰਸਾਤ ਦੇ ਕਾਰਨ ਅਸੀਂ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ ਪਰ ਉਹ ਆਪਣੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਕਿਉਂਕਿ ਇਸ ਦੇ ਨਾਲ ਭਿਆਨਕ ਤੋਂ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਨੇ ਅਤੇ ਆਪਣੇ ਬਰਸਾਤ ਦੇ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਅਸੀਂ ਘਰਾਂ ਦੇ ਬਾਹਰ ਕੂਲਰ ਵੀ ਲਗਾਏ ਹੁੰਦੇ ਹਨ ਉਹਨਾਂ ਦੇ ਵਿੱਚ ਵੀ ਪਾਣੀ ਸਟੇਅ ਕਰ ਜਾਂਦਾ ਹੈ ਅਤੇ ਬੱਚੇ ਵੀ ਬਾਹਰ ਖੇਡਣ ਜਾਂਦੇ ਹਨ ਉਹਨਾਂ ਦੀ ਵੀ ਆਪਾਂ ਨੂੰ ਕੇਅਰ ਕਰਨੀ ਪੈਂਦੀ ਹੈ ਬੱਚੇ ਮੰਨ ਲਓ ਘਰ ਤੋਂ ਬਾਹਰ ਖੇਡਣ ਜਾਂਦੇ ਆ ਅਤੇ ਉਹਨਾਂ ਦੇ ਕੋਈ ਨਾ ਕੋਈ ਓਡੋਮੋਸ ਜਾਂ ਤੇਲ ਵਗੈਰਾ ਲਗਾ ਕੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੀਦਾ ਹੈ ਔਰ ਘਰ ਦੇ ਜਿਹੜੇ ਕੂਲਰਾਂ ਦੀ ਸਫਾਈ ਬਹੁਤ ਹੀ ਧਿਆਨ ਪੂਰਵਕ ਕਰਨੀ ਚਾਹੀਦੀ ਹੈ ਔਰ ਇਹਦੇ ਬਚਾਅ ਲਈ ਮੰਨ ਲਓ ਘਰਾਂ ਦੇ ਆਲੇ ਦੁਆਲੇ ਨਾਲੀਆਂ ਹੁੰਦੀਆਂ ਹਨ ਉਹਦੇ ਵਿੱਚ ਤੁਸੀਂ ਪੈਟਰੋਲ ਦਾ ਛਿੜਕਾਅ ਕਰ ਸਕਦੇ ਹੋ ਔਰ ਜਿਹੜਾ ਜਲਿਆ ਹੋਇਆ ਮੁਗਲੈਲ ਅਨਯੂਜ ਹੁੰਦਾ ਉਹ ਉਸਦੀ ਤੁਸੀਂ ਵਰਤੋਂ ਕਰ ਸਕਦੇ ਹੋ ਅਤੇ ਜਿਹੜਾ ਪਾਣੀ ਉਹ ਸਟੇਅ ਨਾ ਹੋਵੇ ਜੀ ਇਸ ਦੀ ਜ਼ਿਆਦਾ ਤੋਂ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ